ਆਪ ਜੀ ਦੇ ਪ੍ਰਸ਼ਨ ਮੁਤਾਬਿਕ ਪੰਜ ਅੰਤਰਰਾਸ਼ਟਰੀ ਸ਼ਹਿਰਾਂ ਦੇ ਨਾਂ ਦੱਸਣੇ ਹਨ ਮੈਂ ਸਭ ਤੋਂ ਪਹਿਲਾਂ ਭਾਰਤ ਦੇਸ਼ ਦਾ ਅੰਤਰਰਾਸ਼ਟਰੀ ਸ਼ਹਿਰ ਬੰਬੇ ਮੁੰਬਈ ਦਾ ਨਾਂ ਦੱਸਣਾ ਚਾਹੁੰਦਾ ਹਾਂ ਅਤੇ ਦੂਸਰੇ ਨੰਬਰ 'ਤੇ ਭਾਰਤ ਦਾ ਅੰਤਰਰਾਸ਼ਟਰੀ ਸ਼ਹਿਰ ਭਾਰਤ ਦੀ ਰਾਜਧਾਨੀ ਦਿੱਲੀ ਅਤੇ ਤੀਸਰੇ ਨੰਬਰ 'ਤੇ ਅਮੈਰੀਕਾ ਦੇ ਨਿਊਯਾਰਕ ਸ਼ਹਿਰ ਦਾ ਨਾਂ ਦੱਸਣਾ ਚਾਹੁੰਦਾ ਹਾਂ ਚੌਥੇ ਨੰਬਰ 'ਤੇ ਇੰਗਲੈਂਡ ਦੇ ਸ਼ਹਿਰ ਲੰਡਨ ਦਾ ਨਾਂ ਲੈ ਦੱਸਣਾ ਚਾਹੁੰਦਾ ਹਾਂ ਅਤੇ ਸਭ ਤੋਂ ਅਖੀਰ ਤੇ ਹੋਂਗਕੋਂਗ ਸ਼ਹਿਰ ਦਾ ਨਾਂ ਦੱਸਣਾ ਚਾਹੁੰਦਾ ਹਾਂ